ਹੈਲੋ ਫੇਸਿਸ ਕਨੇਡਾ ਤੋਂ ਬੋਲ ਰਹੇ ਹੋ ਮੈਂ ਤੁਹਾਥੋਂ ਇੱਕ ਲਿਪਸਟਿਕ ਔਡਰ ਕੀਤੀ ਸੀ ਜਦੋਂ ਉਹ ਡਿਲੀਵਰੀ ਆਈ ਤਾਂ ਲਿਪਸਟਿਕ ਟੁੱਟੀ ਹੋਈ ਸੀ ਜੋ ਕਿ ਬਹੁਤ ਮੇਰਾ ਇਸ ਦੇ ਨਾਲ਼ ਮਾੜਾ ਐਕਸਪੀਰੀਅੰਸ ਹੋਇਆ ਕਿਰਪਾ ਕਰਕੇ ਇਹ ਡਿਲੀਵਰੀ ਵਾਪਸ ਲੈ ਜਾਉ